ਹੈਲੋ ਐਚ ਪੀ ਏਜੰ ਗੈਂਸ ਏਜੰਸੀ ਤੋਂ ਜੀ ਮੈਂ ਭਾਈ ਸਾਹਿਬ ਕੱਲ੍ਹ ਇੱਕ ਸਿਲੰਡਰ ਬੁੱਕ ਕਰਵਾਇਆ ਸੀ ਅਤੇ ਜੋ ਕਿ ਹੁਣ ਇਸ ਟਾਈਮ ਮੈਨੂੰ ਉਹਦੀ ਜ਼ਰੂਰਤ ਨਹੀਂ ਹੈ ਅਤੇ ਮੇਰੀ ਉਹ ਬੁਕਿੰਗ ਕੈਂਸਲ ਕੀਤੀ ਜਾਵੇ ਅਤੇ ਮੇਰਾ ਮੋਬਾਈਲ ਨੰਬਰ ਅਠਾਨਵੇਂ ਇੱਕ ਸੌ ਉਣੰਜਾ ਚੁਹੱਤਰ ਪੰਜ ਸੌ ਪੰਜ ਹੈ